ਹਾਂ ਮੈਂ ਇੱਕ ਵਾਰ ਹਾਈਕਿੰਗ ਦੌਰਾਨ ਗੁਆਚ ਗਿਆ ਸੀ ਜਦੋਂ ਮੈਂ ਗੁਆਚ ਗਿਆ ਤਾਂ ਮੈਨੂੰ ਇਹ ਯਕੀਨ ਨਹੀਂ ਸੀ ਕਿ ਮੈਂ ਕਿੱਥੇ ਜਾ ਰਿਹਾ ਹਾਂ ਪਹਿਲਾ ਕਦਮ ਸੀ ਸ਼ਾਂਤੀ ਨਾਲ ਸਥਿਤੀ ਦਾ ਅੰਦਾਜ਼ਾ ਲੈਣਾ ਅਤੇ ਕਈ ਵਾਰ ਮੁੜ ਕੇ ਦੇਖਣਾ ਮੈਂ ਆਪਣੇ ਰਸਤੇ ਦੇ ਨਿਸ਼ਾਨ ਖੋਜੇ ਅਤੇ ਦਿਸ਼ਾ ਪ੍ਰਦਰਸ਼ਕਾਂ ਜਾਂ ਰਿਪੋਰਟ ਕਰਨ ਵਾਲੇ ਨਿਸ਼ਾਨਾ ਦੀ ਪਛਾਣ ਕੀਤੀ ਵਾਪਸ ਜਾਣ ਦਾ ਰਸਤਾ ਮਿਲਣ ਤੋਂ ਬਾਅਦ ਮੈਂ ਇੱਕ ਜ਼ਰੂਰੀ ਸਾਵਧਾਨੀ ਵੀ ਵਰਤੀ ਕਦੇ ਵੀ ਸੂਰਜ ਢਲਣ ਤੋਂ ਪਹਿਲਾਂ ਮੁੜ ਆਉਣਾ ਇਸ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਸਭ ਕੁਝ ਸਹੀ ਹੈ ਅਤੇ ਸਹੀ ਸਮੇਂ 'ਤੇ ਵਾਪਸ ਆ ਜਾਣਾ ਚਾਹੀਦਾ ਹੈ ਦੂਜਾ ਪਾਣੀ ਅਤੇ ਖਾਣਾ ਖਾਣੇ ਨਾਲ ਖਾਸ ਤੌਰ 'ਤੇ ਸਾਵਧਾਨ ਰਹਿਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ